ਯੋਗ ਦਾ ਅਭਿਆਸ ਕਰਨ ਤੋਂ ਬਾਅਦ ਮੈਨੂੰ ਬਹੁਤ ਸਾਰੇ ਫ਼ਇਦੇ ਮਿਲਦੇ ਹਨ ਮੇਰਾ ਬੀ ਪੀ ਸੈਟ ਰਹਿੰਦਾ ਹੈ ਮੈਂ ਸਾਰਾ ਦਿਨ ਆਪਣੇ ਆਪ ਨੂੰ ਫਰੈਸ਼ ਸਮਝਦਾ ਹਾਂ ਖਿੜਿਆ ਖਿੜਿਆ ਰਹਿੰਦਾ ਹਾਂ ਹੱਸਦਾ ਹਾਂ ਟੈਨਸ਼ਨ ਮੇਰੇ ਤੋਂ ਦੂਰ ਭੱਜਦੀ ਹੈ ਮੈਨੂੰ ਕਈ ਬਿਮਾਰੀਆਂ ਸੀ ਸਾਰੀਆਂ ਤੋਂ ਮੈਨੂੰ ਰਾਹਤ ਮਿਲ ਗਈ ਹੈ ਤਾਂ ਯੋਗ ਕਰਨ ਦੇ ਨਾਲ ਮੈਂ ਬਹੁਤ ਆਪਣੇ ਆਪ ਦੇ ਵਿੱਚ ਸੁਧਾਰ ਮਹਿਸੂਸ ਕਰ ਰਿਹਾ ਹਾਂ